ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਤਾਂ ਆਪ ਜੀ ਨੂੰ ਜੀ ਆਇਆਂ ਨੂੰ ਕਿ ਆਪ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਆਏ ਹੋ ਦੂਸਰਾ ਇਹ ਚੀਜ਼ ਦਾ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿ ਇਹ ਜਿਹੜੀ ਟੂਰਿਸਟ ਪਲੇਸ ਨਹੀਂ ਆ ਇਹ ਧਾਰਮਿਕ ਅਸਥਾਨ ਆ ਇੱਥੇ ਇੱਕ ਖਾਸ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਵਿਚਰਨਾ ਹੁੰਦਾ ਤੁਸੀਂ ਸੇਵਾਵਾਂ ਨਿਭਾਉਣ ਦਾ ਤੁਹਾਡਾ ਮਨ ਆ ਤਾਂ ਤੁਸੀਂ ਜੋੜਾ ਘਰ ਦੇ ਵਿੱਚ ਜਾ ਕੇ ਆਪਣੀ ਸੇਵਾ ਨਿਭਾ ਸਕਦੇ ਹੋ ਅਤੇ ਲੰਗਰ ਹਾਲ ਦੇ ਵਿੱਚ ਜਾ ਕੇ ਬਰਤਨ ਸਾਫ ਕਰਨ ਦੀ ਸੇਵਾ ਕਰ ਸਕਦੇ ਹੋ ਪ੍ਰਸ਼ਾਦਾ ਵਰਤਾਉਣ ਦੀ ਸੇਵਾ ਕਰ ਸਕਦੇ ਹੋ ਸਬਜ਼ੀ ਕੱਟਣ ਦੀ ਸੇਵਾ ਕਰ ਸਕਦੇ ਹੋ ਤਾਂ ਹੋਰ ਬਹੁਤ ਸਾਰੀਆਂ ਸੇਵਾਵਾਂ ਝਾੜੂ ਦੀ ਪੋਚੇ ਦੀ ਇਹ ਸਾਰੀਆਂ ਸੇਵਾਵਾਂ ਤੁਸੀਂ ਨਿਭਾ ਸਕਦੇ ਹੋ ਅਤੇ ਸੇਵਾ ਨਿਰੰਤਰ ਚੱਲਦੀ ਰਹਿੰਦੀ ਆ ਲੰਗਰ ਹਾਲ ਵੀ ਚੌਵੀ ਘੰਟੇ ਦੇ ਲਈ ਇੱਥੇ ਚੱਲਦਾ ਰਹਿੰਦਾ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੁਸੀਂ ਉੱਥੇ ਸਾਰੀਆਂ ਸੇਵਾਵਾਂ ਆਪਣੀਆਂ ਜਾ ਕੇ ਨਿਭਾ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਵੇ ਤਾਂ ਉੱਥੇ ਸਾਡੇ ਸੇਵਾਦਾਰ ਮੌਜੂਦ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ